ਖਬਰਾਂ ਵਿੱਚ ਦਿਖਾਈਆਂ ਗਈਆਂ ਚੀਜ਼ਾਂ ਅਤੇ ਹਕੀਕਤ ਵਿੱਚ ਵਾਪਰ ਰਹੀਆਂ ਚੀਜ਼ਾਂ ਵਿੱਚ ਕਾਫ਼ੀ ਅੰਤਰ ਹੁੰਦਾ ਹੈ ਖਬਰਾਂ ਵਿੱਚ ਲੋੜ ਤੋਂ ਵੱਧ ਦਿਖਾਇਆ ਜਾਂਦਾ ਹੈ ਅਤੇ ਮਸਾਲੇ ਲਾ ਲਾ ਕੇ ਦਿਖਾਇਆ ਜਾਂਦਾ ਹੈ ਜਦੋਂ ਕਿ ਹਕੀਕਤ ਵਿੱਚ ਬਹੁਤ ਫਰਕ ਹੁੰਦਾ ਹੈ ਹਕੀਕਤ ਵਿੱਚ ਓਹੀ ਹੁੰਦਾ ਹੈ ਜਿਸ 'ਤੇ ਬੀਤੀ ਹੁੰਦੀ ਹੈ ਅਤੇ ਉਹ ਸੱਚ ਹੁੰਦਾ ਹੈ ਪਰ ਇਹਦੇ ਉਲਟ ਲੋਕ ਜੋ ਗਲਤ ਹੁੰਦਾ ਹੈ ਉਹਨੂੰ ਸੱਚ ਮੰਨ ਬੈਠਦੇ ਹਨ ਅਤੇ ਜੋ ਸੱਚ ਹੁੰਦਾ ਹੈ ਉਹਨੂੰ ਮੰਨਦੇ ਨਹੀਂ ਅਤੇ ਇਹ ਬਹੁਤ ਵੱਡਾ ਫਰਕ ਹੈ ਕਿ ਜੋ ਹੁੰਦਾ ਹੈ ਲੋਕ ਉਸਨੂੰ ਸੱਚ ਮੰਨਦੇ ਹੀ ਨਹੀਂ ਹਨ ਜਿਹਦੇ ਵਿੱਚ ਮਸਾਲੇ ਜ਼ਿਆਦਾ ਹੁੰਦੇ ਹਨ ਲੋਕ ਉਹਨੂੰ ਸੱਚ ਮੰਨ ਬੈਠਦੇ ਹਨ ਅਤੇ ਜਾਅਲੀ ਖਬਰਾਂ ਸਾਡੇ ਆਲੇ ਦੁਆਲ਼ੇ ਬਹੁਤ ਮਿਲਦੀਆਂ ਹਨ ਹੁੰਦਾ ਕੁਝ ਹੈ ਅਤੇ ਦੱਸਦੇ ਕੁਛ ਹਨ ਅਤੇ ਸਮਾਜ ਵਾਲੇ ਉਸ ਨੂੰ ਸੱਚ ਮੰਨ ਲੈਂਦੇ ਹਨ ਅਤੇ ਫਿਰ ਬਾਦ ਵਿੱਚ ਪਛਤਾਉਂਦੇ ਹਨ ਜੋ ਕਿ ਸਾਡੇ ਸਮਾਜ ਦੇ ਉੱਪਰ ਨੌਜਵਾਨਾਂ ਉੱਪਰ ਕਾਫ਼ੀ ਮਾੜਾ ਅਸਰ ਪੈ ਰਿਹਾ ਹੈ ਜੀ ਧੰਨਵਾਦ